ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਆਪਣੇ ਪਰਿਵਾਰ ਦੀ ਕਦਰ ਕਰਦੀ ਹਾਂ ਸਾਨੂੰ ਆਪਣੇ ਪਰਿਵਾਰ ਦੇ ਹਰੇਕ ਮੈਂਬਰ ਦੀ ਕਦਰ ਅਤੇ ਸਤ ਸਨਮਾਨ ਕਰਨਾ ਚਾਹੀਦਾ ਹੈ ਸਭ ਤੋਂ ਵੱਧ ਕਦਰ ਮੈਂ ਆਪਣੀ ਵੱਡੀ ਭੈਣ ਅਤੇ ਆਪਣੇ ਮਾਪਿਆਂ ਦੀ ਕਰਦੀ ਹਾਂ ਉਹਨਾਂ ਦੀ ਮੈਂ ਹਰੇਕ ਗੱਲ ਮੰਨਦੀ ਹਾਂ ਉਹਨਾਂ ਦਾ ਕਿਹਾ ਮੈਂ ਕਦੇ ਨਹੀਂ ਮੋੜਦੀ ਮੈਂ ਉਹਨਾਂ ਨਾਲ਼ ਆਪਣੀ ਕੋਈ ਵੀ ਗੱਲ ਸ਼ੇਅਰ ਕਰ ਕਰ ਸਕਦੀ ਹਾਂ ਜਦੋਂ ਕਿ ਮੈਂ ਕਿਸੇ ਉਲਝਣ ਵਿੱਚ ਹੁੰਦੀ ਹਾਂ ਤਾਂ ਮੈਂ ਉਹਨਾਂ ਨੂੰ ਉਹਨਾਂ ਦੀ ਸਲਾਹ ਲੈਂਦੀ ਹਾਂ ਜੋ ਅਤੇ ਉਹ ਮੈਨੂੰ ਸਿੱਧੇ ਰਸਤੇ 'ਤੇ ਪਾ ਦਿੰਦੇ ਹਨ ਅਤੇ ਮੈਂ ਆਪਣੀ ਵੱਡੀ ਭੈਣ ਨਾਲ਼ ਹਰੇਕ ਗੱਲ ਸ਼ੇਅਰ ਕਰਦੀ ਹਾਂ ਹਰੇਕ ਹਰ ਗੱਲ ਜੋ ਮੈਨੂੰ ਨਹੀਂ ਸਮਝ ਆਉਂਦੀ ਮੈਂ ਉਸ ਤੋਂ ਪੁੱਛ ਲੈਂਦੀ ਹਾਂ ਅਤੇ ਉਹ ਮੇਰੀ ਪੜ੍ਹਾਈ ਵਿੱਚ ਵੀ ਮੇਰੀ ਹੈਲਪ ਕਰਦੀ ਹੈ ਮੇਰੀ ਮਦਦ ਕਰਦੀ ਹੈ ਅਤੇ ਮੈਂ ਆਪਣੀ ਵੱਡੀ ਭੈਣ ਨਾਲ਼ ਕਿਤੇ ਘੁੰਮਣ ਵੀ ਚਲੇ ਜਾਦੀ ਹਾਂ ਸਾਨੂੰ ਆਪਣੇ ਪਰਿਵਾਰ ਨਾਲ਼ ਪਿਆਰ ਰੱਖਣਾ ਚਾਹੀਦਾ ਹੈ ਅਤੇ ਓ ਆਪਣੇ ਪਰਿਵਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਡੀ ਸਾਡੀ ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਜ਼ਿੰਦਗੀ ਵਿੱਚ ਪਰਿਵਾਰ ਹੋਣਾ ਚਾਹੀਦਾ ਹੈ